ਬਰਤਨ ਧੋਣ ਲਈ ਸਾਨੂੰ ਸਭ ਤੋਂ ਪਹਿਲੇ ਪਾਣੀ ਗਰਮ ਕਰ ਲੈਣਾ ਚਾਹੀਦਾ ਹੈ ਜਿਸ ਵਿੱਚ ਸਾਨੂੰ ਡਿਸ਼ਵੋਸ਼ ਪਾ ਲੈਣਾ ਚਾਹੀਦਾ ਹੈ ਜਿਸ ਨਾਲ ਬਰਤਨ ਬਹੁਤ ਵਧੀਆ ਸਾਫ ਹੁੰਦੇ ਹਨ ਸਾਡਾ ਤੇ ਘਰ ਵਿੱਚ ਰੋਜ਼ ਦਾ ਕੰਮ ਹੀ ਹੈ ਰੋਜ਼ ਦਾ ਕੰਮ ਹੀ ਹੈ ਸਵੇਰੇ ਸ਼ਾਮ ਬਰਤਨ ਧੋ ਕੇ ਚਮਕਾ ਕੇ ਅਸੀਂ ਲਾਉਂਦੇ ਹਾਂ ਸਭ ਤੋਂ ਵਧੀਆ ਚੀਜ਼ ਸਾਨੂੰ ਹਮੇਸ਼ਾ ਸਟੀਲ ਦੇ ਬਰਤਨਾਂ ਵਿੱਚ ਹੀ ਖਾਣਾ ਖਾਣਾ ਚਾਹੀਦਾ ਹੈ ਪਲਾਸਟਿਕ ਦੇ ਬਰਤਨ ਸਾਡੇ ਲਈ ਸਾਡੇ ਬੱਚਿਆਂ ਲਈ ਸਾਡੇ ਬਜ਼ੁਰਗਾਂ ਲਈ ਬਹੁਤ ਹੀ ਹਾਨੀਕਾਰਕ ਸਾਬਿਤ ਹੋ ਸਕਦੇ ਹਨ ਇਸ ਲਈ ਸਾਨੂੰ ਚਾਹੀਦਾ ਹੈ ਕੀ ਅਸੀਂ ਵੱਧ ਤੋਂ ਵੱਧ ਸਟੀਲ ਦੇ ਬਰਤਨਾਂ ਦਾ ਸੇਵਨ ਕਰੀਏ ਅਤੇ ਉਸ ਨੂੰ ਖਾਣਾ ਖਾਣ ਤੋਂ ਬਾਅਦ ਉਸਨੂੰ ਗਰਮ ਪਾਣੀ ਦੇ ਨਾਲ ਹੀ ਚੰਗੀ ਤਰਹਾਂ ਧੋ ਕੇ ਸਾਫ ਕਰਕੇ ਰੱਖੀਏ ਜਿਸ ਨਾਲ ਗੰਦਗੀ ਨਹੀਂ ਆਏਗੀ ਅਤੇ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਬਰਤਨ ਸਾਫ ਹੋ ਸਕਦੇ ਹਨ ਤੇ ਰਹਿ ਸਕਦੇ ਹਨ ਜਿਸ ਨਾਲ ਸਾਡਾ ਬਰਤਨ ਧੋਣ ਦਾ ਜਿਸ ਨਾਲ ਬਰਤਨ ਵੀ ਸਾਫ ਰਹਿਦੇ ਹਨ ਤੇ ਸਾਡੀ ਗੰਦਗੀ ਅੰਦਰ ਨਹੀਂ ਜਾਏਗੀ ਜਿਸ ਨਾਲ ਸਾਡਾ ਸਾਡੀ ਸਿਹਤ ਵੀ ਵਧੀਆ ਰਹੇਗੀ ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਬਰਤਨ ਗਰਮ ਪਾਣੀ ਨਾਲ ਹੀ ਧੋਈਏ ਭਾਵੇਂ ਸਰਦੀਆਂ ਹਨ ਭਾਵੇਂ ਗਰਮੀਆਂ ਹਨ ਸਾਨੂੰ ਹਮੇਸ਼ਾ ਗਰਮ ਪਾਣੀ ਨਾਲ ਹੀ ਬਰਤਨ ਧੋਣੇ ਚਾਹੀਦੇ ਹਨ ਜਿਸ ਨਾਲ ਜਮਸ ਵੀ ਘੱਟ ਪੈਦਾ ਹੋਣਗੇ ਅਤੇ ਅਸੀਂ ਬਿਮਾਰ ਵੀ ਘੱਟ ਹੋਵਾਂਗੇ ਧੰਨਵਾਦ